ਹੈਲੋ ਅਸੀਂ ਪਿੰਡ ਦੇ ਵਿੱਚ ਰਹਿੰਦੇ ਹਾਂ ਹੁਣ ਅਸੀਂ ਸ਼ਹਿਰ ਦੇ ਵਿੱਚ ਆਉਣਾ ਚਾਹੁੰਦੇ ਹਾਂ ਅਤੇ ਤੁਸੀਂ ਸਾਡੀ ਉਸ ਬਾਰੇ ਮਾਮਲੇ 'ਚ ਕੋਈ ਹੈਲਪ ਕਰ ਸਕਦੇ ਹੋ

ਹਾਂਜੀ ਚਲੋ ਅਸੀਂ ਫਿਰ ਘਰੇ ਸਲਾਹ ਕਰਾਂਗੇ ਅਤੇ ਸਾਡੀ ਸਲਾਹ ਬਣ ਗਈ ਅਤੇ ਮੈਂ ਤੁਹਾਨੂੰ ਦੱਸ ਦੇਵਾਂਗੀ ਅਤੇ ਫਿਰ ਤੁਸੀਂ ਸਾਡੀ ਹੈਲਪ ਕਰਿਆ ਜੇ ਅਤੇ ਬੱਚਿਆਂ ਦੇ ਜਾਣ ਵਾਸਤੇ ਵਹੀਕਲ ਵੁਹੀਕਲ ਦਾ ਵੀ ਕੋਈ ਅਰੇਂਜ ਕਰ ਦਿਓ ਜੇ ਅਤੇ ਬਾਕੀ

ਵੀ ਹਾਂ ਵਹੀਕਲ ਵਾਲਿਆਂ ਦੇ ਨਾਲ ਜਾਣ ਪਛਾਣ ਅਤੇ ਫਿਰ ਅਜੇ ਤੱਕ ਸਾਡੀ ਤੋਂ ਹਾਂ ਇਸ ਵਾਸਤੇ ਇਸੇ ਵਾਸਤੇ ਹੀ ਅਸੀਂ ਸ਼ਹਿਰ ਵਿਚ ਆਉਣਾ ਚਾਹੁੰਦੇ ਹਾਂ ਨਾ ਪਿੰਡਾਂ ਦੇ ਵਿੱਚ ਨਾ ਸਾਡੇ ਬੱਚਿਆਂ ਨੂੰ ਬਹੁਤ ਜ਼ਿਆਦਾ ਮੁਸ਼ਕਿਲਾਂ ਆਉਂਦੀਆਂ ਨੇ ਇਸ ਵਾਸਤੇ ਅਸੀਂ ਜਲਦੀ ਤੋਂ ਜਲਦੀ ਹਾਂਜੀ ਹਾਂ ਹਾਂਜੀ ਠੀਕ ਹੈ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ